ਜੇਕਰ ਮੈਨੂੰ ਕਿਸੇ ਵੱਖਰੇ ਦੇਸ਼ ਵਿੱਚ ਯਾਤਰਾ ਕਰਨ ਦਾ ਮੌਕਾ ਮਿਲੇ ਤਾਂ ਮੈਂ ਆਸਟ੍ਰੇਲੀਆ ਵਿੱਚ ਜਾਣਾ ਚਾਹਾਂਗਾ ਕਿਉਂਕਿ ਉੱਥੋਂ ਦਾ ਮੌਸਮ ਅਤੇ ਇੱਥੋਂ ਦਾ ਮੌਸਮ ਕੁਝ ਜ਼ਿਆਦਾ ਫ਼ਰਕ ਨਹੀਂ ਹੈ ਅਤੇ ਮੈਨੂੰ ਉੱਥੋਂ ਆਪਣੇ ਆਪ ਨੂੰ ਐਡਜਸਟ ਕਰਨ 'ਚ ਦਿੱਕਤ ਨਹੀਂ ਆ ਆਵੇਗੀ ਅਤੇ ਨਾਲੇ ਮੈਂ ਉੱਥੇ ਆਪਣੇ ਆਪ ਨੂੰ ਅ ਸੈਟਲ ਵੀ ਕਰਨਾ ਚਾਹਾਂਗਾ ਕਿਉਂਕਿ ਉੱਥੋਂ ਦਾ ਰੁਜ਼ਗਾਰ ਇੱਥੋਂ ਦੇ ਰੁਜ਼ਗਾਰ ਤੋਂ ਕਾਫੀ ਵਧੀਆ ਹੈ ਅਤੇ ਨਾਲੇ ਮੈਨੂੰ ਉੱਥੋਂ ਦੇ ਕ੍ਰਿਕਟ ਮੈਚ ਦੇਖਣ ਦਾ ਬੜਾ ਸ਼ੌਕ ਹੈ ਅ ਜਿੱਦਾਂ ਕਿ ਬ੍ਰਿਸਬਿਨ ਖਿਡਨੀ ਵਰਗੀਆਂ ਗਰਾਊਂਡਾਂ ਦੇ ਵਿੱਚ ਇੰਡੀਆ ਦਾ ਆਸਟ੍ਰੇਲੀਆ ਨਾਲ ਮੈਚ ਹੋਵੇ ਤਾਂ ਮੈਂ ਉਹਨੂੰ ਦੇਖਣਾ ਚਾਹਵਾਂਗਾ ਮੇਰੀ ਦਿਲ ਦੀ ਖਵਾਹਿਸ਼ ਹੈ ਨਾਲੇ ਉੱਥੇ ਨਾਲੇ ਉੱਥੇ ਦੇ ਜਿਹੜੇ ਸਰਕਾਰੀ ਰੂਲ ਐਂਡ ਰੈਗੂਲੇਸ਼ਨ ਨੇ ਕਾਫੀ ਅੱਛੇ ਨੇ ਅਤੇ ਮੇਰੇ ਹਿਸਾਬ ਨਾਲ ਮੈਂ ਉੱਥੇ ਜਾ ਕੇ ਜ਼ਿਆਦਾ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਹਾਂ ਇਸ ਕਰਕੇ ਮੈਂ ਆਸਟ੍ਰੇਲੀਆ 'ਚ ਜਾ ਕੇ ਘੁੰਮਣਾ ਫਿਰਨਾ ਅਤੇ ਰਹਿਣਾ ਪਸੰਦ ਕਰਾਂਗਾ ਧੰਨਵਾਦ ਜੀ